ਹੈਲੋ ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਮੋਹਾਲੀ ਸਟੇਸ਼ਨ ਤੋਂ ਬੋਲ ਰਹੇ ਹੋ ਜੀ ਮੋਹਾਲੀ ਤੋਂ ਬਾਏ ਟਰੇਨ ਅਸੀਂ ਘੁੰਮਣ ਜਾਣਾ ਏ ਟ੍ਰੈਵਲਿੰਗ 'ਤੇ ਜਾਣਾ ਏ ਸਾਨੂੰ ਇਹਦੀ ਚਾਰਜਿਸ ਬਾਰੇ ਖਾਣ ਪੀਣ ਦੀ ਫੈਸਿਲੀਟੀ ਬਾਰੇ ਦੱਸਿਓ ਜੀ ਡੀਟੇਲ 'ਚ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਠੀਕ ਹੈ ਸਰ ਸਰ ਇਹ ਚਾਰਜਿਸ ਕੀ ਹੋਣਗੇ ਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਠੀਕ ਹੈ ਸਰ ਖਾਣ ਪੀਣ ਦੀ ਫੈਸਿੱਲਟੀ ਹੈ ਸਾਫ਼ ਸਫਾਈ ਕਿੱਦਾਂ ਦੀ ਹੈ ਜੀ ਡੱਬਿਆਂ ਦੇ ਵਿੱਚ ਹਾਂਜੀ ਹੂੰ ਹੂੰ ਠੀਕ ਹੈ ਸਰ ਔਰ ਸਾਫ਼ ਸਫ਼ਾਈ ਸਰ ਸਾਫ਼ ਸਫ਼ਾਈ ਬਾਰੇ ਵੀ ਦੱਸ ਦਿਉ ਠੀਕ ਹੈ ਸਰ ਠੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਓਕੇ ਸਰ ਥੈਂਕ ਯੂ